ਹਾਂਜੀ ਮੈਂ ਅੱਜ ਬਹੁਤ ਹੀ ਇੱਕ ਸੁੰਦਰ ਸਥਾਨ ਦਾ ਵਰਣਨ ਕਰਨ ਜਾ ਰਹੀ ਹਾਂ ਮੈਂ ਛੁੱਟੀਆਂ ਵਿੱਚ ਜੰਮੂ ਕਸ਼ਮੀਰ ਦੇ ਇਲਾਕੇ 'ਚ ਗਈ ਸੀ ਉੱਥੇ ਬਹੁਤ ਜ਼ਿਆਦਾ ਚੜਾਈ ਹੈਗੀ ਹੈ ਬਹੁਤ ਜ਼ਿਆਦਾ ਵਧੀਆ ਬਹਾਰ ਬਹੁਤ ਸੋਹਣੀ ਰੁੱਤ ਹੈਗੀ ਹੈ ਉੱਥੇ ਬਹੁਤ ਜ਼ਿਆਦਾ ਪਹਾੜ ਬਣੇ ਹੋਏ ਆ ਪਹਾੜ ਚੜ੍ਹ ਕੇ ਉੱਥੇ ਬਰਫ਼ ਦਾ ਬਹੁਤ ਜ਼ਿਆਦਾ ਵਧੀਆ ਸਥਾਨ ਹੈਗਾ ਵਾ ਉਚਾਈਆਂ 'ਤੇ ਚੜ੍ਹਨ ਦਾ ਬਹੁਤ ਹੀ ਮਜ਼ਾ ਆਉਂਦਾ ਉੱਥੇ ਕਈ ਰੇਡਿੰਗ ਵਗੈਰਾ 'ਤੇ ਵੀ ਚੜ੍ਹਦੇ ਹਨ ਕਈ ਘੋੜਿਆਂ 'ਤੇ ਵੀ ਜਾ ਕੇ ਚੜ੍ਹਦੇ ਹਨ ਅਤੇ ਮੈਂ ਖੁਦ ਜੰਮੂ ਕਸ਼ਮੀਰ 'ਚ ਜਾ ਕੇ ਵੇਖਿਆ ਉੱਥੋਂ ਦੀਆਂ ਜਗ੍ਹਾ ਬਹੁਤ ਸੋਹਾਣੀਆਂ ਹੈਗੀਆ ਉੱਥੋਂ ਦਾ ਮੌਸਮ ਬਹੁਤ ਸੁਹਾਣਾ ਹੈ ਉੱਥੇ ਉੱਚੀਆਂ ਉੱਚੀਆਂ ਪਹਾੜੀਆਂ ਹੈਗੀਆਂ ਬਹੁਤ ਸਾਰੇ ਉੱਥੋਂ ਦੇ ਜਿਵੇਂ ਧਰਤੀ ਬਹੁਤ ਸੁਹਾਵਣੀ ਹੈ ਜੰਮੂ ਕਸ਼ਮੀਰ ਦੀ ਧਰਤੀ ਬਹੁਤ ਸੁਹਾਵਣੀ ਆ ਉੱਥੋਂ ਦੇ ਪਹਾੜ ਬਹੁਤ ਉੱਚੇ ਹਨ ਉੱਥੋਂ ਦੀਆਂ ਜਗ੍ਹਾ ਬਹੁਤ ਸੋਹਣੀਆਂ ਹਨ ਉੱਥੋਂ ਦਾ ਸ਼ਹਿਰ ਬੜਾ ਵਧੀਆ ਹੈਗਾ ਵਾ ਉੱਥੋਂ ਦੀਆਂ ਪਹਾੜੀਆਂ 'ਤੇ ਚੜ੍ਹ ਕੇ ਬਹੁਤ ਵਧੀਆ ਸੈ ਕਈ ਲੋਕ ਪਹਾੜੀਆਂ ਚੜ੍ਹ ਕੇ ਸੈਰ ਵੀ ਕਰਦੇ ਹਨ ਆਪਣੇ ਸਰੀਰ ਨੂੰ ਪ੍ਰਫੁੱਲਿਤ ਰੱਖਦੇ ਹਨ ਠੰਡੀਆਂ ਹਵਾਵਾਂ ਵੀ ਉੱਤੇ ਸਮੁੰਦਰ ਵਗੈਰਾ ਵੀ ਹੈਗੇ ਹੈ ਸਮੁੰਦਰ ਵਗੈਰਾ ਸਮੁੰਦਰ ਲਾਗੇ ਬੈਠ ਕੇ ਆਪਣੇ ਤਨ ਮਨ ਨੂੰ ਸ਼ੁੱਧ ਰੱਖਦੇ ਹਨ ਪਹਾੜੀਆਂ ਉੱਤੇ ਚੜ੍ਹ ਕੇ ਆਪਣੀ ਸਾਹ ਦੀ ਓਕਸੀਜ਼ਨ ਨੂੰ ਸਹੀ ਰੱਖਦੇ ਹਨ